ਖਾਣ ਲਈ ਸਾਡੇ ਮਨਪਸੰਦ ਕਿਸ ਮਨਪਸੰਦ ਭੋਜਨ ਹਰੀਆਂ ਸਬਜ਼ੀਆਂ ਹਨ ਕਿਉਂਕਿ ਹਰੀਆਂ ਸਬਜ਼ੀਆਂ ਵਿੱਚ ਇੱਕ ਤਾਂ ਫਾਈਬਰ ਹੁੰਦਾ ਹੈ ਬਾਕੀ ਉਹ ਸਾਡੇ ਸਰੀਰ ਵਿੱਚ ਜਲਦੀ ਡਾਇਜੈਸਟ ਹੋ ਜਾਂਦੀਆਂ ਹਨ ਸਾਡਾ ਪੋਸ਼ਣ ਵਿੱਚ ਵਾਧਾ ਕਰਦੀਆਂ ਹਨ ਉਨ੍ਹਾਂ ਵਿੱਚ ਕੋਈ ਵੀ ਮਿਲਾਵਟ ਨਹੀਂ ਹੁੰਦੀ ਹਰੀਆਂ ਸਬਜ਼ੀਆਂ ਸਾਡੀ ਸਿਹਤ ਨੂੰ ਚੰਗਾ ਚੰਗੀ ਸਿਹਤ ਪ੍ਰਦਾਨ ਕਰਦੀਆਂ ਹਨ ਜਿਵੇਂ ਅੱਖਾਂ ਦੀ ਰੋਸ਼ਨੀ ਵਧਾਉਂਦੀਆਂ ਹਨ ਹਰੀ ਜਿਵੇਂ ਹਰੀ ਮਿਰਚ ਲਾ ਲਉ ਹਰੀਆਂ ਸਬਜ਼ੀਆਂ ਸਾਰੀਆਂ ਖੀਰਾ ਹੋ ਗਿਆ ਵੀ ਇਹਨਾਂ ਦਾ ਹੀ ਇਹਨਾਂ ਨੂੰ ਹੀ ਸਾਨੂੰ ਮਨਪਸੰਦ ਦਾ ਹੀ ਖਾਣਾ ਬਣਾਉਣਾ ਚਾਹੀਦਾ ਹੈ ਸਾਨੂੰ ਜਦੋਂ ਵੀ ਅਸੀਂ ਬਾਹਰਲਾ ਖਾਣਾ ਖਾਂਦੇ ਹਾਂ ਨਾ ਸਾਡੇ ਸਰੀਰ ਨੂੰ ਹਾਨੀਕਾਰਕ ਪਹੁੰਚਦਾ ਹੈ ਉਸ ਨਾਲ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਦੋਂ ਵੀ ਅਸੀਂ ਬਾਹਰਲਾ ਖਾਣਾ ਖਾਂਦੇ ਹਾਂ ਤਾਂ ਸਾਨੂੰ ਪਹਿਲਾਂ ਤਾਂ ਐਸਿਡ ਬਣਦਾ ਹੈ ਦੂਸਰਾ ਸਾਡਾ ਸਿਰ ਦਰਦ ਤੀਸਰਾ ਪੇਟ ਦੀਆਂ ਕਾਫ਼ੀ ਪ੍ਰੋਬਲਮਸ ਆ ਜੋ ਸਿਹਤ ਲਈ ਹਾਨੀਕਾਰਕ ਹੈ ਸਾਨੂੰ ਜ਼ਿਆਦਾ ਮਸਾਲੇ ਵਾਲੇ ਭੋਜਨ ਨਹੀਂ ਖਾਣੇ ਚਾਹੀਦੇ ਮੇਰੇ ਖਾਣ ਪੀਣ ਦੇ ਮਨਪਸੰਦ ਦਾ ਭੋਜਨ ਮੈਂ ਕਹਿ ਸਕਦੀ ਹਾਂ ਕਿ ਸਿੰਪਲ ਰੋਟੀ ਹਰੀਆਂ ਸਬਜ਼ੀਆਂ ਮੱਖਣ ਆਦਿ ਸਾਨੂੰ ਸੇਵਨ ਕਰਨਾ ਚਾਹੀਦਾ ਜੋ ਸਾਡੇ ਸਰੀਰ ਨੂੰ ਫਿੱਟ ਰੱਖਦੀਆਂ ਹਨ ਅਤੇ ਚ ਤੰਦਰੁਸਤ ਬਣਾਉਂਦੀਆਂ ਹਨ ਚੰਗੀ ਸਿਹਤ ਹੋਊਗੀ ਤਾਂ ਅਸੀਂ ਚੰਗਾ ਲਿਹਾਜ਼ ਦੇਖ ਸਕਦੇ ਹਾਂ ਦੁਨੀਆ ਦੇ ਵਿੱਚ ਸ ਇਸ ਲਈ ਸਾਨੂੰ ਚੰਗੀ ਸਿਹਤ ਬਣਾਉਣ ਲਈ ਹਰੀਆਂ ਸਬਜ਼ੀਆਂ ਸਿੰਪਲ ਭੋਜਨ ਦਾ ਹੀ ਸੇਵਨ ਕਰਨਾ ਚਾ ਜੋ ਕਿ ਸਾਡੀ ਸਿਹਤ ਚੰਗੀ ਦਿੱਖ ਸਕੀਏ ਅਤੇ ਅਸੀਂ ਫਿੱਟ ਰਹਿ ਸਕੀਏ ਧੰਨਵਾਦ